ਵੈਸੇ ਤਾਂ ਦੇਖਿਆ ਜਾਵੇ ਤਾਂ ਮੇਰਾ ਸਾਇੰਸ ਦੇ ਨਾਲ ਕੋਈ ਇੰਟਰਸਟ ਜ਼ਿਆਦਾ ਨਹੀਂ ਹੈ ਬਟ ਪਿਛਲੇ ਸੰਡੇ ਮੈਂ ਐਵੇਂ ਹੀ ਫੋਨ ਯੂਜ ਕਰਦੀ ਪਈ ਸੀਗੀ ਅਤੇ ਮੈਨੂੰ ਉੱਤੇ ਨੋਟੀਫਿਕੇਸ਼ਨ ਆਇਆ ਅਤੇ ਜਿਹਦੇ ਵਿੱਚ ਐਵੇਂ ਦੱਸਿਆ ਸੀ ਕਿ ਉੱਪਰ ਮੰ ਮੰਗਲ ਗ੍ਰਹਿ ਦੇ ਉੱਤੇ ਵੀ ਕੋਈ ਗਿਆ ਜਾਂ ਐਵੇਂ ਦੀ ਕੋਈ ਨੋਟੀਫਿਕੇਸ਼ਨ ਆਈ ਮੈਂ ਉਹਨੂੰ ਓਪਨ ਕੀਤਾ ਥੋੜ੍ਹਾ ਜਿਹਾ ਰੀਡ ਕੀਤਾ ਜਿਹਦੇ ਵਿੱਚ ਉੱਥੇ ਜਿਹੜੇ ਵੀ ਹੋਰ ਗ੍ਰਹਿ ਵਗੈਰਾ ਸੀ ਉਹਨਾਂ ਬਾਰੇ ਦੱਸਿਆ ਗਿਆ ਸੀਗਾ ਜਿਹਦੇ ਕਰਕੇ ਮੇਰਾ ਥੋੜ੍ਹਾ ਇੰਟਰਸਟ ਹੋਰ ਹੋ ਗਿਆ ਅਤੇ ਮੈਂ ਉਹਨੂੰ ਥੋੜ੍ਹਾ ਹੋਰ ਜ਼ਿਆਦਾ ਡੀਪਲੀ ਰੀਡ ਕਰਨਾ ਸ਼ੁਰੂ ਕਰਤਾ ਅਤੇ ਮੈਨੂੰ ਵਧੀਆ ਲੱਗਿਆ ਜਿਹਦੇ ਵਿੱਚ ਲਿਖਿਆ ਸੀਗਾ ਕਿ ਉੱਥੇ ਹੋਰ ਵੀ ਮਤਲਬ ਕਿ ਜਿਹੜੇ ਇੱਥੋਂ ਜਾਂਦੇ ਆ ਉੱਥੇ ਜਾ ਕੇ ਉਹ ਸਟੇਅ ਕਰਦੇ ਆ ਬਟ ਦੇਖਿਆ ਜਾਵੇ ਤਾਂ ਉਹ ਇੱਥੋਂ ਇਹ ਵੀ ਹੁੰਦਾ ਹੈ ਕਿ ਇੱਥੇ ਧਰਤੀ ਦੇ ਉੱਤੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਥੋੜ੍ਹਾ ਕੀਤਾ ਹੋਇਆ ਇੱਕ ਗਲਤ ਮਿਸਯੂਜ ਕਰਦੇ ਆ ਪਰ ਇਹ ਵੀ ਉੱਥੇ ਜਾ ਕੇ ਵੀ ਐਵੇਂ ਨਾ ਕਰਨ ਇਸ ਕਰਕੇ ਸਾਨੂੰ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ ਇਸ ਗੱਲ 'ਤੇ